ਭੰਗੜੇ ਦੇ ਕੁਛ ਆਮ ਸਟੈਪ ਹਨ ਜਿਵੇਂ ਝੂਮਰ ਲੁੱਡੀ ਧਮਾਲ ਇਹ ਸਾਰੇ ਭੰਗੜੇੇ ਦੇ ਹੀ ਸਟੈਪ ਹਨ ਜੋ ਜਿਸ ਵੇਲੇ ਜਦੋਂ ਬੰਦਾ ਭੰਗੜਾ ਕਰਦਾ ਹੈ ਤਾਂ ਇਹ ਵਾਲੇ ਮੁੱਖ ਸਟੈਪ ਹਨ ਜਿਹੜੇ ਹਰ ਇੱਕ ਬੰਦਾ ਇਹਨੂੰ ਕਰ ਸਕਦਾ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਪੰਜਾਬ ਵਿੱਚ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਕਿਸੀ ਵੀ ਵਿਆਹ 'ਤੇ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਕਿਸੇ ਦੇ ਘਰ ਨਿਆਣਾ ਹੋਇਆ ਜਾਂ ਕੁਛ ਵੀ ਕਿਸੇ ਵੀ ਤਰੀਕੇ ਦਾ ਖੁਸ਼ੀ ਦਾ ਮੌਕਾ ਹੋਵੇ ਤਾਂ ਪੰਜਾਬ ਦੇ ਪੰਜਾਬੀ ਭੰਗੜੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪਾਉਂਦੇ ਹਨ ਢੋਲ ਭੰਗੜੇ ਦਾ ਮੁੱਖ ਸਾਜ਼ ਹੈ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਕਿਤੇ ਵੀ ਪੰਜਾਬੀ ਰਹਿੰਦੇ ਹਨ ਉਹ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਭੰਗੜਾ ਨਾ ਪਾਉਣ ਉਹ ਹਰ ਇੱਕ ਮੌਕੇ 'ਤੇ ਭੰਗੜਾ ਪਾਉਂਦੇ ਹਨ ਕਿਉਂਕਿ ਭੰਗੜਾ ਪਾ ਕੇ ਉਹਨਾਂ ਨੂੰ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਦੇਖਣ ਵਾਲਾ ਬੰਦਾ ਵੀ ਭੰਗੜੇ ਨੂੰ ਬੜਾ ਖੁਸ਼ ਹੁੰਦਾ ਹੈ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਵਿਸਾਖੀ ਦੇ ਤਿਉਹਾਰ 'ਤੇ ਵੀ ਪਾਇਆ ਜਾਂਦਾ ਹੈ ਕਿਸੇ ਦੇ ਘਰ ਨਿਆਣਾ ਹੋਇਆ ਹੁੰਦਾ ਲੋਹੜੀ 'ਤੇ ਅਤੇ ਤਾਂ ਵੀ ਉਹ ਭੰਗੜਾ ਪਾਉਂਦੇ ਹਨ ਅਗਰ ਕਿਸੇ ਦੇ ਘਰ ਵਿਆਹ ਹੋਇਆ ਹੁੰਦਾ ਕੁੜੀ ਦੇ ਮੁੰਡੇ ਦੇ ਦੋਹਾਂ ਦੇ ਵਿਆਹ 'ਤੇ ਭੰਗੜਾ ਪਾਉਂਦੇ ਹਨ ਭੰਗੜਾ ਇੱਕ ਇੱਦਾਂ ਦਾ ਨਾਚ ਗੀਤ ਨਾਚ ਹੈ ਜੋ ਕੇਵਲ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਹਰ ਇੱਕ ਥਾਂ ਵਿੱਚ ਭੰਗੜਾ ਬੜੀ ਹੀ ਖੁਸ਼ੀ ਨਾਲ ਪਾਇਆ ਜਾਂਦਾ ਹੈ